ਭਾਰਤ ਵਿੱਚ ਬਹੁਤ ਸਾਰੇ ਧਰਮ ਨੂੰ ਲੈ ਕੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਹਲ ਹਰੇਕ ਰ ਰਿਲੀਜਨ ਦਾ ਅਲੱਗ ਅਲੱਗ ਤਿਉਹਾਰ ਹੁੰਦਾ ਹੈ ਆ ਹੈ ਨਾ ਜਿਵੇਂ ਜਿਵੇਂ ਸਿੱਖ ਲਈ ਹੋ ਗਿਆ ਉਹ ਮਤਲਬ ਗੁਰਦੁਆਰੇ ਜਾਂਦੇ ਆ ਅਤੇ ਮੁਸਲਿਮ ਹੋ ਗਿਆ ਉਹ ਮਸਜਿਦ ਜਾਂਦੇ ਆ ਹਿੰਦੂ ਹੋ ਗਿਆ ਉਹ ਜਿੱਦਾਂ ਮੰਦਰ ਵਗੈਰਾ ਮੰਦਰ ਜਾਂਦੇ ਆ ਅਤੇ ਜਿਹੜੇ ਕ੍ਰਿਸ਼ਚਨ ਹੋ ਗਿਆ ਉਹ ਚਰਚ ਨੂੰ ਮੰਨਦੇ ਆ ਹਰੇਕ ਧਰਮ ਅਲੱਗ ਅਲੱਗ ਅਲੱਗ ਅਲੱਗ ਧਰਮਿਕ ਸਥਾਨ 'ਤੇ ਜਾਂਦੇ ਨੇ ਆਪਣੀ ਮਾਨਤਾ ਕਰਨ ਉਹ ਆਪਣੀ ਸ਼ਰਧਾ ਅਨੁਸਾਰ ਉੱਥੇ ਮਾਨਤਾ ਕਰਦੇ ਆ ਪਾਠ ਪੂਜਾ ਕਰਦੇ ਆ ਹੈ ਨਾ ਅਤੇ ਇਸ ਲਈ ਮਤਲਬ ਅਲੱਗ ਅਲੱਗ ਜਾਂਦੇ ਆ ਜਿਹੜੇ ਬਹੁਤ ਜਿੱਦਾਂ ਹਿੰਦੂਆਂ ਲਈ ਬਹੁਤ ਸਾਰੇ ਮੰਦਰ ਬਣੇ ਹੋਏ ਆ ਵੀ ਉਹ ਜਾ ਕੇ ਸ਼ਿਵ ਮੰਦਰ ਹੋ ਗਿਆ ਸ਼ਿਵ ਮੰਦਰ ਹੋ ਗਿਆ ਅਤੇ ਹੋਰ ਪਾਰਵਤੀ ਦਾ ਮੰਦਰ ਹੋ ਗਿਆ ਅਤੇ ਉਹ ਜਿਵੇਂ ਗੁਰਦੁਆਰਾ ਸਾਹਿਬ ਹੋ ਗਿਆ ਹਰ ਇੱਕ ਜਗ੍ਹਾ ਮਤਲਬ ਹਰ ਇੱਕ ਪਿੰਡ 'ਚ ਜਾਂ ਆਪਾਂ ਹਾ ਕਹਿ ਦੀਏ ਹਰ ਇੱਕ ਸ਼ਹਿਰ 'ਚ ਹੈ ਨਾ ਇੱਕ ਜਾਂ ਦੋ ਮੰਦਰ ਜਾਂ ਗੁਰਦੁਆਰਾ ਜਾਂ ਮਸਜਿਦ ਹੁੰਦੀ ਆ ਜਿਹਦੇ ਮਤਲਬ ਉ ਉੱਥੇ ਰਹਿ ਰਹੇ ਲੋਕ ਆਪਣੇ ਧਰਮ ਨੂੰ ਨਾਲ ਨਾਲ ਰੱਖਦੇ ਆ ਅਤੇ ਧਰਮ ਦੇ ਅਨੁਸਾਰ ਮਤਲਬ ਅਲੱਗ ਅਲੱਗ ਅ ਤਿਉਹਾਰ ਵੀ ਮਨਾਏ ਜਾਂਦੇ ਹਨ ਜਿਵੇਂ ਮੁਸਲਿਮ ਮੁਸਲਿਮ ਮਨਾਉਂਦੇ ਨੇ ਈਦ ਅਤੇ ਸਿੱਖ ਮਨਾਉਂਦੇ ਨੇ ਗੁਰਪੁਰਬ ਗੁਰੂਆਂ ਦਾ ਜਨਮ ਦਿਨ ਅਤੇ ਜਿਹੜੇ ਹਿੰਦੂ ਹੁੰਦੇ ਨੇ ਉਹ ਜਿਵੇਂ ਦਿਵਾਲੀ ਜਿਵੇਂ ਅ ਦਿਵਾਲੀ ਗੋਵਰਧਨ ਪੂਜਾ ਇੱਦਾਂ ਦੇ ਤਿਉਹਾਰ ਮਨਾਉਂਦੇ ਨੇ ਜਿਹੜੇ ਕ੍ਰਿਸ਼ਚਨ ਹੁੰਦੇ ਨੇ ਉਹਨਾਂ ਉਹ ਬਾਹਰਲੇ ਮਤਲਬ ਕ੍ਰਿਸ਼ਚਨ ਆਪਣੇ ਜਿਹੜੇ ਇੰਡੀਆ 'ਚ ਨੇ ਉਹ ਘੱਟ ਹੀ ਆ ਅਤੇ ਉਹ ਆਪਣੇ ਅਲੱਗ ਤਿਉਹਾਰ ਮਨਾਉਂਦੇ ਨੇ ਫੋਰਨ 'ਚ ਜ਼ਿਆਦਾ ਨੇ ਕ੍ਰਿਸ਼ਚਨ